ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਹਾਂਜੀ ਕਰੋ ਜੀ ਫਿਰ ਅੱਛਾ ਅੱਠ ਤੋਂ ਦੱਸ ਲੱਖ ਦੀ ਤੁਹਾਨੂੰ ਘੱਟ ਤੁਹਾਨੂੰ ਘੱਟ ਰੇਟ ਦੀ ਦੇਵਾ ਦੇਈਏ ਜੇ ਅੱਛਾ ਕਿਹੜੀ ਕੰਪਨੀ ਦੀ ਚਾਹੀਦੀ ਹੈ ਸਰ ਅੱਛਾ ਅੱਛਾ ਫੋਰਡ ਦੇ ਵਿੱਚ ਅੱਛਾ ਹੁੰਡਈ ਦੇ ਵਿੱਚ ਕਿਹੜੀ ਗੱਡੀ ਚਾਹੀਦੀ ਤੁਹਾਨੂੰ ਵਰਨਾ ਹੈਗੀ ਹੈ ਜੀ ਕਰੇਟਾ ਹੈਗੀ ਹੈ ਜੀ ਕਰੇਟਾ ਵੀ ਮਿਲ ਜੂਗੀ ਕਰੇਟਾ ਤੁਹਾਨੂੰ ਮਿਲ ਜੂਗਾ ਜੀ ਦੋ ਦੋ ਹਜ਼ਾਰ ਤੇਰ੍ਹਾਂ ਮਾਡਲ ਸੱਤ ਲੱਖ ਦੀ ਕਿਲੋਮੀਟਰ ਪੰਜਾਹ ਕੁ ਹਜ਼ਾਰ ਕਿਲੋਮੀਟਰ ਚੱਲੀ ਹੋਵੇਗੀ ਜੀ ਘਰ ਖੜ੍ਹੀ ਹੈ ਅਤੇ ਨਵੇਂ ਟਾਇਰ ਹੈ ਪੈਟਰੋਲ ਹੈ ਜੀ ਹਾਂਜੀ ਸਰ ਤੁਹਾਡੇ ਨਾਮ 'ਤੇੇ ਕਰਵਾ ਕੇ ਦੇਵਾਂਗੇ ਉਹਦੇ ਉਹਦੇ ਪੈਸੇ ਐਕਸਟ੍ਰਾ ਹੋਣਗੇ ਜੀ ਉਹਦਾ ਘੱਟੋ ਘੱਟ ਤੁਸੀਂ ਲਗਾ ਕੇ ਚੱਲੋ ਜੀ ਚਾਲ਼ੀ ਕੁ ਹਜ਼ਾਰ ਦੇ ਆਸ ਪਾਸ ਹਾਂਜੀ ਨਹੀਂ ਸਰ ਜਿੱਥੇ ਮਰਜ਼ੀ ਚਲਾਉ ਸਰ ਤੁਸੀਂ ਜਿੱਥੇ ਮਰਜ਼ੀ ਨੈਣਾਂ ਦੇਵੀ ਲੈ ਜਾਉ ਉਹ ਤੋਂ ਬਾਅਦ ਚਾਹੇ

ਨਾ ਜੀ ਨਾ ਪੁਲਿਸ ਵਾਲਿਆਂ ਦੀ ਕਯਾ ਦਿੱਕਤ ਆਉਣੀ ਤੁਹਾਨੂੰ ਪੂਰੀ ਪਾਸਿੰਗ ਕਰਵਾ ਕੇ ਦੇਵਾਂਗੇ ਹਾਂਜੀ ਇਹ ਜਿਹੜੀ ਵਰਨਾ ਚੱਲੀ ਹੋਈ ਹੈ ਇਹ ਸੱਤਰ ਕਿਲੋਮੀਟਰ ਚੱਲੀ ਹੋਈ ਹੈ ਸਾਫ਼ ਗੱਡੀ ਹੈ ਜੀ ਬਿਲਕੁਲ ਸਕ੍ਰੈਚਲੈੱਸ ਹਾਂਜੀ ਹਾਂਜੀ ਹਾਂਜੀ ਨਹੀਂ ਜੀ ਨਹੀਂ ਬਸ ਜਦੋਂ ਦੀ ਲਿਆਏ ਹੈ ਜੀ ਅਸੀਂ ਉਦੋਂ ਦੀ ਘਰ ਖੜ੍ਹਾ ਕੇ ਰੱਖੀ ਹੋਈ ਹੈ ਮਾੜੀ ਜਿਹੀ ਬਸ ਗੇੜੀ ਜਿਹੀ ਮਰਾ ਲੈਂਦੇ ਜੀ ਬਾਹਰ ਨੂੰ ਹਾਂਜੀ ਹਾਂ ਬਸ ਚਲਾਈ ਨਹੀਂ ਜੀ ਹੈ ਬਸ ਜੀਅ ਨਹੀਂ ਕਰਿਆ ਜੀ ਚਲਾਉਣ ਨੂੰ ਨਹੀਂ ਠੀਕ ਹੈ ਜੀ ਆ ਜਾਉ ਆ ਜਾਉ ਚੰਗਾ ਜੀ ਸਤਿ ਸ਼੍ਰੀ ਅਕਾਲ